ਮੇਰਾ ਮਨ ਪਸੰਦ ਪੌਦਾ ਤੁਲਸੀ ਕੜੀ ਪੱਤਾ ਧਨੀਆ ਪੁਦੀਨਾ ਅਤੇ ਨਿੰਮ ਦਾ ਪੌਦਾ ਹੈ ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ ਅਤੇ ਫੁੱਲਾਂ ਵਿੱਚੋਂ ਸਭ ਤੋਂ ਮਨ ਪਸੰਦ ਪੌਦਾ ਗੁਲਾਬ ਦਾ ਹੈ ਕਿਉਂਕਿ ਉਹ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗਦਾ ਹੈ